ਪੰਜਾਬੀ ਭਾਸ਼ਾ ਸਿਰਫ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਨਹੀਂ ਵਰਤੀ ਜਾਂਦੀ ਬਲਕਿ ਪੂਰੇ ਸੰਸਾਰ ਦੇ ਵਿੱਚ ਵਰਤੀ ਜਾਂਦੀ ਹੈ ਹੁਣ ਤਾਂ ਈਵਨ ਕੈਨੇਡਾ ਦੀ ਵੀ ਸੈਕਿੰਡ ਲੈਂਗੁਏਜ਼ ਜਿਹੜੀ ਹੈ ਪੰਜਾਬੀ ਹੈ ਜਿੱਥੋਂ ਤੱਕ ਇਹ ਕਿ ਹਾਂ ਪੰਜਾਬੀ ਜਦੋਂ ਸਾਰੇ ਹਿੱਸਿਆਂ ਦੇ ਵਿੱਚ ਚਾਹੇ ਭਾਰਤ ਹੋਵੇ ਚਾਹੇ ਸੰਸਾਰ ਹੋਵੇ ਪੂਰਾ ਉੱਥੇ ਰਹਿੰਦੇ ਨੇ ਤਾਂ ਸੱਭਿਆਚਾਰਕ ਵਟਾਂਦਰਾ ਤਾਂ ਡੈਫੀਨੇਟਲੀ ਹੁੰਦਾ ਕਿਉਂਕਿ ਪੰਜਾਬੀ ਜਿਹੜੇ ਬੜੇ ਖੁੱਲ੍ਹ ਦਿਲ ਦੇ ਹੁੰਦੇ ਹੈ ਔਰ ਕਿਤੇ ਵੀ ਕੋਈ ਅਬੀ ਨਬੀ ਹੋ ਜਾਵੇ ਤਾਂ ਉੱਥੇ ਸਭ ਤੋਂ ਪਹਿਲਾ ਹਿੱਸਾ ਜਿਹੜਾ ਹੁੰਦਾ ਉਹ ਪੰਜਾਬੀਆਂ ਦਾ ਹੁੰਦਾ ਜਦੋਂ ਆਪਣਾ ਕੋਂਟਰੀਬਿਊਸ਼ਨ ਦਿੰਦੇ ਨੇ ਚਾਹੇ ਕੋਈ ਭੂਚਾਲ ਹੋਣ ਜਾ ਕਿਤੇ ਕੋਈ ਮਾੜੀ ਬਿਪਤਾ ਪੈ ਜਾਵੇ ਤਾਂ ਈਵਨ ਜਦੋਂ ਕੋਵਿਡ ਸੀਗਾ ਉਹਦੇ ਵਿੱਚ ਵੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਸੋ ਹੁਣ ਤਾਂ ਸਾਰਿਆਂ ਨੂੰ ਹੈ ਪਤਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਜੇ ਕਿਤੇ ਵੀ ਕੋਈ ਚੀਜ਼ ਇੱਦਾਂ ਹੁੰਦੀ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਅੱਗੇ ਆ ਕੇ ਖੜ੍ਹਦੇ ਨੇ ਬਾਕੀ ਪੰਜਾਬੀ ਮਿਹਨਤੀ ਵੀ ਬਹੁਤ ਹੁੰਦੇ ਨੇ ਕੰਮ ਕਾਰ ਵਧੀਆ ਉਨ੍ਹਾਂ ਦਾ ਚੱਲਦਾ ਹਰ ਜਗ੍ਹਾ 'ਤੇ ਉਹਨਾਂ ਨੇ ਆਪਣੀਆਂ ਇੰਡਸਟਰੀਸ ਅਸਟੈਬਲਿਸ਼ ਕੀਤੀਆਂ ਹੋਈਆਂ ਨੇ ਜਾਂ ਵੱਡੇ ਵੱਡੇ ਜਿੰਨੇ ਵੀ ਕਾਰੋਬਾਰ ਨੇ ਉੱਥੇ ਪੰਜਾਬੀ ਜਿਹੜੇ ਨੇ ਉੱਥੇ ਸੈਟਲ ਡਾਊਨ ਨੇ ਸੰਚਾਰ ਵਿੱਚ ਇਹ ਹੈ ਕਿ ਪੰਜਾਬੀ ਜਿਹੜੇ ਨੇ ਹਰ ਜਗ੍ਹਾ ਹੈਗੇ ਨੇ ਤਾਂ ਇਸੇ ਕਰਕੇ ਉਹ ਪੰਜਾਬੀ ਆਪਣਾ ਹਰ ਜਗ੍ਹਾ ਆਪਣਾ ਯੋਗਦਾਨ ਦਿੰਦੇ ਨੇ ਹਰ ਜਗ ਚੀਜ਼ ਦੇ ਵਿੱਚ ਚਾਹੇ ਉਹ ਸਟੱਡੀਜ਼ ਹੋਵੇ ਬਿਜ਼ਨਸ ਹੋਵੇ ਮੋਟੀਵੇਸ਼ਨ ਹੋਵੇ ਜਾਂ ਡੋਨੇਸ਼ਨ ਹੋਵੇ ਹਰ ਜਗ੍ਹਾ ਪੰਜਾਬੀਆਂ ਦਾ ਸਭ ਤੋਂ ਉੱਪਰ ਨਾਮ ਆਉਂਦਾ